ਪੰਜਾਬ ਵਿੱਚ ਕੁਝ ਪ੍ਰਸਿੱਧ ਯਾਦਗਾਰੀ ਚਿੰਨ ਹਨ ਜਿਵੇਂ ਕਿ ਮਿੱਟੀ ਦੇ ਭਾਂਡੇ ਹੋ ਗਏ ਜੁੱਤੀ ਹੋ ਗਈ ਫੁੱਲਕਾਰੀ ਹੋ ਗਈ ਚਾਦਰਾ ਹੋ ਗਿਆ ਕੁੰਡਾ ਹੋ ਗਿਆ ਸੋਟਾ ਹੋ ਗਿਆ ਇਹ ਬਾਹਰੋਂ ਆਏ ਬਾਹਰੋਂ ਆਏ ਬੰਦੇ ਪੰਜਾਬ 'ਚੋਂ ਪੰਜਾਬ 'ਚੋਂ ਇਹ ਯਾਦਗਾਰ ਚੀਜ਼ਾਂ ਲੈ ਕੇ ਜਾ ਸਕਦੇ ਹਨ ਇੱਥੇ ਪ ਆਪਣੇ ਚੌਵੀ ਘੰਟੇ ਪੰਜਾਬ ਵਿੱਚ ਨਾਲੇ ਬਾਹਰ ਆਉਣ ਵਾਲਿਆਂ ਲਈ ਇੱਕ ਲੰਗਰ ਚੌਵੀ ਘੰਟੇ ਚਲਦਾ ਹੈ ਕੋਈ ਵੀ ਬਾਹਰੋਂ ਆ ਕੇ ਇਸ 'ਤੇ ਭੁੱਖਾ ਨਹੀਂ ਮਰ ਸਕਦਾ ਇਸ ਲਈ ਉਹ ਬਾਹਰ ਜਾ ਕੇ ਆਪਣੇ ਸਭ ਨੂੰ ਦੱਸਦੇ ਹਨ ਕਿ ਅਸੀਂ ਜਦੋਂ ਪੰਜਾਬ ਵਿੱਚ ਗਏ ਸਾਂ ਉੱਥੇ ਲੰਗਰ ਸਾਨੂੰ ਫਰੀ ਮਿਲਦਾ ਸੀ ਕੋਈ ਪੈਸਾ ਵੀ ਨਹੀਂ ਲਿੱਤਾ ਜਾਂਦਾ ਸੀ ਅਤੇ ਜਦੋਂ ਮਰਜ਼ੀ ਲੰਗਰ ਛਕੋ ਇ ਇਸ ਲਈ ਪੰਜਾਬ ਦਾ ਸ਼ਾਨ ਨਾਮ ਸ਼ਾਨ ਵੱਧਦਾ ਹੈ ਅਤੇ ਉਹ ਸਾਰਿਆਂ ਨੂੰ ਇਹੋ ਹੀ ਕਹਿੰਦੇ ਹਨ ਜਦੋਂ ਵੀ ਜਾਓ ਪੰਜਾਬ ਵਿੱਚ ਉੱਥੇ ਕੋਈ ਵੀ ਭੁੱਖਾ ਨਹੀਂ ਮਰ ਸਕਦਾ ਨਾਲੇ ਉੱਥੋਂ ਯਾਦਗਾਰ ਸਾਰੀਆਂ ਚੀਜ਼ਾਂ ਲਿਆ ਸਕਦੇ ਹਨ ਮਿੱਟੀ ਦੇ ਭਾਂਡੇ ਹੋ ਗਏ ਗਹਿਣੇ ਹੋ ਗਏ ਬੈਗ ਹੋ ਗਏ ਜੁੱਤੀਆਂ ਹੋ ਗਈਆਂ ਨੱਥ ਹੋ ਗਈ ਬਰਤਨ ਇਹੋ ਜਿਹੀਆਂ ਚੀਜ਼ਾਂ ਆਪਣੀ ਯਾਦਗਾਰੀ ਲਈ ਲੈ ਕੇ ਜਾ ਸਕਦੇ ਹਨ